ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਓਲਾ ਤੋਂ ਗੱਲ ਕਰ ਰਹੇ ਹੋ ਐਕਚੁਅਲੀ ਮੈਂ ਨਾ ਹਲੇ ਉਹ ਹੋਸਪਿਟਲ ਜਾਣਾ ਸੀ ਅਤੇ ਉਹਦੇ ਲਈ ਇੱਕ ਓਲਾ ਬੁੱਕ ਕੀਤੀ ਸੀ ਕੀ ਤੁਸੀਂ ਜਲਦੀ ਆ ਸਕਦੇ ਹੋ ਐਕਚੁਅਲੀ ਮੇਰੇ ਨਾਲ ਨਾ ਇੱਕ ਮਰੀਜ਼ ਹੈ ਜਿਹੜਾ ਥੋੜ੍ਹਾ ਜਿਹਾ ਸਿਚੁਏਸ਼ਨ ਠੀਕ ਨਹੀਂ ਹੈ ਤੁਸੀਂ ਰੋਪੜ ਦੇ ਜਿਹੜੇ ਪਾਵਰ ਕਲੋਨੀ 'ਚ ਦੂਜੇ ਗੇਟ ਹੈ ਨਾ ਉੱਥੇ ਆ ਜਾਉ ਅਤੇ ਕੋਸ਼ਿਸ਼ ਕਰੋ ਤੁਸੀਂ ਛੇਤੀ ਤੋਂ ਛੇਤੀ ਆ ਜਾਉ ਤਾਂ ਕਿ ਆਪਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾ ਸਕਦੇ ਹਨ